ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਜੀ ਬੋਲ ਰਿਹਾ ਵਾਂ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਨੂੰ ਅਗਰ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਕਰੀਏ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਉਹ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਆਖਰੀ ਬਸੇਵਲੀ ਹੈ ਤੁਸੀਂ ਕਰਤਾਰਪੁਰ ਲਾਂਘਾ ਰਾਹੀ ਬਿਨਾਂ ਵੀਜੇ ਤੇ ਜਾ ਸਕਦੇ ਹੋ ਪਰ ਉਸੇ ਵੀ ਬਹੁਤ ਕੁਝ ਨਿਯਮ ਨੇ ਜੋ ਤੁਹਾਨੂੰ ਜਿਨਾਂ ਦੀ ਤੁਹਾਨੂੰ ਪਾਲਣਾ ਕਰਨੀ ਪੜੇ ਪਵੇਗੀ ਹਾਂਜੀ ਹਾਂਜੀ ਜਿਵੇਂ ਕਿ ਪਾਕਿਸਤਾਨ ਇੱਕ ਹੋਰ ਦੇਸ਼ ਹੈ ਤਾਂ ਤੁਹਾਨੂੰ ਉਹਨਾਂ ਦੀ ਨਿਯਮ ਦਾ ਪਾਲਨ ਕਰਨਾ ਪਵੇਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਇਮੀਗ੍ਰੇਸ਼ਨ ਵੈਬਸਾਈਟ ਤੇ ਆਨਲਾਈਨ ਰਜਿਸਟਰੇਸ਼ਨ ਕਰਵਾਣੀ ਪਵੇਗੀ ਉਸ ਤੋਂ ਬਾਅਦ ਤੁਸੀਂ ਯਾਤਰਾ ਕਰ ਸਕਦੇ ਹੋ ਤੇ ਰਜਿਸਟਰੇਸ਼ਨ ਯਾਤਰਾ ਤੋਂ ਘੱਟੋ ਘੱਟ ਦਸ ਦਿਨ ਪਹਿਲਾਂ ਕਰਨੀ ਤੁਹਾਨੂੰ ਲਾਜ਼ਮੀ ਹੈ ਹਾਂਜੀ ਹਾਂਜੀ ਜਦੋਂ ਵੀ ਆਪਾਂ ਇੱਕ ਦੇਰ ਤੋਂ ਦੂਸਰੇ ਦੇਸ਼ ਵਿੱਚ ਜਾਂਦੇ ਆਂ ਤਾਂ ਤੁਹਾਨੂੰ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਹੁੰਦੀ ਹ ਉਹ ਪਾਸਪੋਰਟ ਹੀ ਹੁੰਦਾ ਤਾਂ ਤੁਹਾਨੂੰ ਤੁਹਾਡਾ ਮੌਜੂਦਾ ਪਾਸਪੋਰਟ ਲੈ ਕੇ ਜਾਣਾ ਪਵੇਗਾ ਤਾਂ ਤੁਹਾਨੂੰ ਇਹਦੇ ਵਿੱਚ ਕਿਸੇ ਵੀਜੇ ਦੀ ਲੋੜ ਨਹੀਂ ਪਵੇਗੀ ਕਰਤਾਰਪੁਰ ਲਾਗੇ ਤੇ ਤੁਹਾਨੂੰ ਇਮੀਗ੍ਰੇਸ਼ਨ ਚੈਕਿੰਗ ਹੁੰਦੀ ਹੈ ਨਹੀਂ ਨਹੀਂ ਜੀ ਜਿਦਾਂ ਪਾਕਿਸਤਾਨ ਨਾਲ ਇੰਡੀਆ ਦੀ ਘੱਟ ਹੀ ਬਣਦੀ ਆ ਤਾਂ ਤੁਹਾਨੂੰ ਇਸ ਕਰਕੇ ਉਥੇ ਤੁਸੀਂ ਇੱਕ ਦਿਨ ਨਹੀਂ ਜਾ ਸਕਦੇ ਹੋ ਤੁਸੀਂ ਉਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤਾਂ ਤੁਹਾਨੂੰ ਆਪਣੇ ਦੇਸ਼ ਵਿੱਚ ਵਾਪਿਸ ਆਉਣਾ ਪਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਸਭ ਤੋਂ ਮਹੱਤਵ ਚੀਜ਼ ਆ ਤੇ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਨਿਵਾਸ ਸਥਾਨ ਲੰਗਰ ਹਾਲ ਸਰੋਵਰ ਅਤੇ ਇਤਿਹਾਸਿਕ ਪ੍ਰਦਰਸ਼ਨੀਆਂ ਹਨ ਤਾਂ ਇਦਾਂ ਦੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਦੇਖ ਸਕਦੇ ਹੋ ਹਾ ਜੀ ਜੀ ਬਿਲਕੁਲ ਜਿਵੇਂ ਵੀ ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣਾ ਸਿਰ ਢੱਕ ਕੇ ਰੱਖਣਾ ਪੈਂਦਾ ਉਸ ਤੋਂ ਬਾਅਦ ਨਿਵੇਲਕਾ ਪਹਿਨਾਵਾ ਪਾਓ ਮੀਨਜ ਕੀ ਜਿੱਦਾਂ ਦੇ ਗੁਰਦੁਆਰੇ ਵਿੱਚ ਆਪਣਾ ਪਹਿਨਾਵਾ ਹੋਣਾ ਚਾਹੀਦਾ ਉਦਾਂ ਦਾ ਪਾਓ ਗੁਰਦੁਆਰੇ ਅੰਦਰ ਸ਼ਾਂਤੀ ਬਣਾਈ ਰੱਖੋ ਉਥੇ ਕੋਈ ਰੌਲਾ ਨਹੀਂ ਪਤਾ ਪਾਓ ਅਤੇ ਨਾ ਹੀ ਤੁਸੀਂ ਮੋਬਾਈਲ ਦੀ ਵਰਤੋਂ ਕਰੋ ਤੇ ਉਸ ਤੋਂ ਸਭ ਤੋਂ ਵੱਡਾ ਨਿਯਮ ਹੈ ਕਿ ਤੁਸੀਂ ਉੱਥੇ ਵੀ ਕਿਤੇ ਵੀ ਪ੍ਰਕਾਰ ਦੀ ਗੁਰਦੁਆਰੇ ਦੇ ਅੰਦਰ ਦੀ ਫੋਟੋਗ੍ਰਾਫੀ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਜੀ ਤੁਹਾਡੇ ਜਦੋਂ ਵੀ ਜਾਣ ਦੀ ਯੋਜਨਾ ਬਣੇ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਮੈਂ ਤੁਹਾਡੀ ਮਦਦ ਲਈ ਹਮੇਸ਼ਾ ਹੀ ਹਾਜ਼ਰ ਹਾਂ ਸਤਿ ਸ੍ਰੀ ਅਕਾਲ